ਅਤੇ ਪੈਸੇ ਚੋਰੀ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਮੈਂ ਜ਼ਿਆਦਾਤਰ ਆਪਣੇ ਕਾਰਡ ਦੀ ਵਰਤੋਂ ਦੁਕਾਨ ਤੋਂ ਖਰੀਦਦਾਰੀ ਕਰਨ ਲਈ ਜਾਂ ਔਨਲਾਈਨ ਖਰੀਦਦਾਰੀ ਕਰਨ ਸਮੇਂ ਹੀ ਜ਼ਿਆਦਾਤਰ ਕਰਦੀ ਹਾਂ